ਸਿੱਖਿਅਤ ਹੋਣਾ ਜ਼ਿੰਦਗੀ ਵਿੱਚ ਬਹੁਤ ਮਦਦਗਾਰ ਸਿੱਧ ਹੁੰਦਾ ਹੈ ਕਿਉਂਕਿ ਜੋ ਸਿੱਖਿਅਤ ਲੋਕ ਹੁੰਦੇ ਹੈ ਉਹ ਬਹੁਤ ਜਲਦੀ ਚੀਜ਼ਾਂ ਨੂੰ ਸਮਝ ਜਾਂਦੇ ਹੈ ਜਿਹੜੇ ਕਿ ਅਨਪੜ੍ਹ ਲੋਕ ਨਹੀਂ ਸਮਝ ਪਾਉਂਦੇ ਸਿੱਖਿਅਤ ਲੋਕਾਂ ਨੂੰ ਆਪਣੀ ਸਿਹਤ ਬਾਰੇ ਬਹੁਤ ਜਲਦੀ ਪਤਾ ਲੱਗ ਜਾਂਦਾ ਏ ਕਿ ਆਪਣੀ ਸਿਹਤ ਨੂੰ ਕਿਵੇਂ ਠੀਕ ਰੱਖਣਾ ਅਤੇ ਕਿਵੇਂ ਆਪਣੀ ਜ਼ਿੰਦਗੀ ਜਿਉਣੀ ਹੈ ਜੋ ਕਿ ਅਨਪੜ੍ਹ ਲੋਕ ਨਹੀਂ ਸਮਝ ਪਾਉਂਦੇ